ਇੱਕ ਬਾਈਕਰ ਨੂੰ ਬਾਈਕ ਚਲਾਉਣ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਕਿ ਬਾਈਕ ਚਲਾਉਣਾ ਕਿਹੜੇ ਪਾਸੇ ਆ ਸਹੀ ਗਲਤ ਦਾ ਉਹਨੂੰ ਪਤਾ ਹੋਣਾ ਚਾਹੀਦਾ ਮੰਨ ਲਓ ਆਪਾਂ ਜਾਣਾ ਸੱਜੇ ਪਾਸੇ ਉਹ ਖੱਬੇ ਪਾਸੇ ਤੁਰਿਆ ਜਾਵੇ ਸਭ ਤੋਂ ਪਹਿਲਾਂ ਰੂਲ ਹੀ ਇਹ ਆ ਕਿ ਉਹਨੂੰ ਪਤਾ ਹੋਣਾ ਚਾਹੀਦਾ ਵੀ ਮੋਟਰਸਾਈਕਲ ਕਿਹੜੇ ਪਾਸੇ ਚਲਾਉਣਾ ਉਸ ਤੋਂ ਬਾਅਦ ਉਹਨੂੰ ਆਪਣੀਆਂ ਜਿਹੜੀਆਂ ਲਾਈਟਾਂ ਲੱਗੀਆਂ ਹੁੰਦੀਆਂ ਉਹਨਾਂ ਬਾਰੇ ਪੂਰਨ ਤੌਰ 'ਤੇ ਜਾਣਕਾਰੀ ਹੋਣੀ ਚਾਹੀਦੀ ਹੈ ਕਿਉਂਕਿ ਉਹ ਮੇਨ ਚੀਜ਼ ਹੈ ਜੇ ਉਹਨੂੰ ਨਹੀਂ ਪਤਾ ਹੋਊਗਾ ਮੰਨ ਲਓ ਵੀ ਰੈਡ ਲਾਈਟ 'ਤੇ ਨਹੀਂ ਲੰਘਣਾ ਤਾਂ ਉਹਨੇ ਮੰਨ ਲਓ ਲੰਘਾ ਦਿੱਤੀ ਰੈਡ ਲਾਈਟ 'ਤੇ ਅਤੇ ਦੂਸਰੀ ਸਾਈਡ ਤੋਂ ਜੇ ਕਿਸੇ ਦੀ ਗ੍ਰੀਨ ਲਾਈਟ ਹੋਈ ਹੋਵੇ ਹੋਰ ਸੜਕ ਤੋਂ ਤਾਂ ਉਹ ਤਾਂ ਇੱਕ ਐਕਸੀਡੈਂਟ ਦਾ ਕਾਰਨ ਬਣੂਗਾ ਉਹ ਤਾਂ ਨੁਕਸਾਨ ਆਪਦਾ ਵੀ ਕਰੂਗਾ ਅਤੇ ਨਾਲ ਦੂਜੇ ਦਾ ਵੀ ਕਰਵਾਊਗਾ ਮੇਨ ਉਹਨੂੰ ਇਹ ਜਿਹੜੇ ਟਰੈਫਿਕ ਦੇ ਰੂਲ ਪਤਾ ਹੋਣੇ ਚਾਹੀਦੇ ਹਨ ਅਤੇ ਜ਼ਰੂਰੀ ਦਸਤਾਵੇਜ਼ਾਂ ਦੇ ਵਿੱਚ ਸਭ ਤੋਂ ਪਹਿਲਾਂ ਮੋਟਰਸਾਈਕਲ ਦੀ ਰਜਿਸਟਰੇਸ਼ਨ ਸਰਟੀਫਿਕੇਟ ਚਾਹੀਦਾ ਜਿਹਨੂੰ ਆਪਾਂ ਆਰ ਸੀ ਵੀ ਕਹਿ ਦਿੰਦੇ ਹਾਂ ਉਸ ਦੇ ਨਾਲ ਉਹਨੂੰ ਇੰਸ਼ੋਰੈਂਸ ਜਿਹਨੂੰ ਪੰਜਾਬੀ ਵਿੱਚ ਬੀਮਾ ਕਹਿ ਦਿੰਦੇ ਹਾਂ ਪੋਲਿਊਸ਼ਨ ਸਰਟੀਫਿਕੇਟ ਚਾਹੀਦਾ ਉਹਨੂੰ ਉਸ ਦਾ ਡਰਾਈਵਿੰਗ ਲਾਈਸੈਂਸ ਚਾਹੀਦਾ ਜੋ ਕਿ ਅਠਾਰਾਂ ਸਾਲ ਤੋਂ ਘੱਟ ਨਹੀਂ ਮੰਨਦਾ ਇਹ ਚਾਰ ਜਿਹੜੇ ਮੁੱਖ ਦਸਤਾਵੇਜ਼ ਆ ਜਿਹੜੇ ਇੱਕ ਬਾਈਕਰ ਨੂੰ ਚਾਹੀਦੇ ਹਨ ਧੰਨਵਾਦ ਜੀ